ਮੇਰੇ ਚੱਲਣ ਵਾਲੇ ਜੁੱਤੇ ਸਪੋਰਟਸ ਸ਼ੂਜ਼ ਹਨ ਮੈਂ ਹੋਰ ਵੀ ਕਈ ਤਰ੍ਹਾਂ ਦੇ ਜੁੱਤੇ ਪਹਿਨਦਾ ਹਾਂ ਪਰ ਇਹ ਸਭ ਤੋਂ ਜ਼ਿਆਦਾ ਆਰਾਮਦਾਇਕ ਹਨ ਕਿਉਂਕੀ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਰੋਜ਼ ਘੱਟੋ ਘੱਟ ਤਿੰਨ ਤੋਂ ਚਾਰ ਕਿਲੋਮੀਟਰ ਦਾ ਤੁਰਕੇ ਸਫ਼ਰ ਕਰਨਾ ਪੈਂਦਾ ਤੇ ਇਸ ਲਈ ਮੈਨੂੰ ਇੱਕ ਆਰਾਮਦਾਇਕ ਜੁੱਤੇ ਜੋ ਲੰਬੇ ਸਮੇਂ ਲਈ ਵੀ ਚੱਲ ਸਕੇ ਤੇ ਮੇਰੇ ਪੈਰਾਂ ਨੂੰ ਵੀ ਆਰਾਮ ਰਹੇ ਤਾਂ ਮੈਂ ਇਸ ਕਰਕੇ ਮੈਂ ਸਪੋਰਟਸ ਸ਼ੂਜ਼ ਪਹਿਨਦਾ ਹਾਂ ਤੇ ਹੋਰ ਜੁੱਤਿਆਂ ਦੀ ਜੇ ਮੈਂ ਗੱਲ ਕਰਾਂ ਤਾਂ ਉਸ ਵਿੱਚ ਪੰਜਾਬੀ ਜੁੱਤੀ ਜਲਸਾ ਤੇ ਲੋਫਰ ਹੋਰ ਵੀ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਜੁੱਤੇ ਪਹਿਨਦਾ ਹਾਂ ਪਰ ਮੈਨੂੰ ਸਭ ਤੋਂ ਚੰਗੇ ਸਪੋਰਟਸ ਸ਼ੂਜ਼ ਹੀ ਲੱਗਦੇ ਹਨ ਕਿਉਂਕੀ ਇਹ ਹਰੇਕ ਤਰ੍ਹਾਂ ਦੇ ਕੱਪੜਿਆਂ ਨਾਲ ਆਟੋਮੈਟਿਕਲੀ ਹੀ ਫਿੱਟ ਹੋ ਜਾਂਦੇ ਹਨ ਤੇ ਅਸੀਂ ਖੇ ਖਾਸ ਖੇਡ ਕੱਪੜਿਆਂ ਦੀ ਗੱਲ ਕਰੀਏ ਤਾਂ ਮੈਂ ਸ਼ਾਮ ਨੂੰ ਰਨਿੰਗ ਕਰਦਾ ਹਾਂ ਤੇ ਉਸ ਵਿੱਚ ਮੈਂ ਨਿੱਕਰ ਤੇ ਇੱਕ ਗੋਲ ਗਲੇ ਵਾਲੀ ਟੀ ਸ਼ਰਟ ਪਹਿਨਦਾ ਹਾਂ ਕਿਉਂਕੀ ਇਹ ਬਹੁਤ ਜ਼ਿਆਦਾ ਹੀ ਆਰਾਮਦਾਇਕ ਰਹਿੰਦੀ ਹੁੰਦੀ ਦੌੜ ਲਾਉਣ ਵੇਲੇ ਸਾਨੂੰ ਇੱਕ ਆਰਾਮਦਾਇਕ ਕੱਪੜਿਆਂ ਦੀ ਲੋੜ ਹੁੰਦੀ ਹੈ ਕਿਉਂਕੀ ਅਸੀਂ ਜਦੋਂ ਅਸੀਂ ਭੱਜ ਦੌੜ ਕਰਦੇ ਹਾਂ ਤੇ ਸਾਡੇ ਕੱਪੜੇ ਪੱਟਣ ਦੀ ਸਾਨੂੰ ਇੱਕ ਦੁਚਿਤੀ ਵਿੱਚ ਰਹਿੰਦੇ ਹਾਂ ਕੀ ਕੋਈ ਕੱਪੜਾ ਪਾਟ ਨਾ ਜਾਵੇ ਤਾਂ ਕਰਕੇ ਅਸੀਂ ਇੱਕ ਨਿੱਕਰ ਤੇ ਗੋਲ ਗਲੇ ਆਲੀ ਕਮੀਜ਼ ਪਹਿਨ ਕੇ ਸ਼ਾਮ ਨੂੰ ਰਨਿੰਗ ਕਰਦੇ ਹਾਂ ਤੇ ਅਸੀਂ ਜੇ ਹੋਰ ਪਹਿਰਾਵੇ ਦੀ ਗੱਲ ਕਰੀਏ ਤਾਂ ਪੰਜਾਬੀ ਪੰਜਾਬ ਵਿੱਚ ਕੁੜਤਾ ਪਜਾਮਾ ਬਹੁਤ ਜ਼ਿਆਦਾ ਪਹਿਨਿਆ ਜਾਂਦਾ ਤੇ ਅਸੀਂ ਵੀ ਸਾਰੇ ਕੁੜਤੇ ਪਜਾਮੇ ਨੂੰ ਇੱਕ ਚੰਗਾ ਪਹਿਰਾਵਾ ਮੰਨਦੇ ਹਨ ਤੇ ਉਸ ਵਿੱਚ ਆਰਾਮਦਾਇਕ ਫੀਲ ਹੁੰਦਾ ਹੈ ਤੇ ਅਸੀਂ ਖੇਡ ਕੱਪੜੇ ਸਾਨੂੰ ਹੋਰ ਵੀ ਕਈ ਤਰ੍ਹਾਂ ਜਿਵੇਂ ਥੱਲੇ ਟੈਟੀ ਪਾਉਣੀ ਪੈਂਦੀ ਹੈ ਤੇ ਸਾਡੇ ਜਿਹੜੇ ਵਿੱਚ ਸਾਨੂੰ ਪੂਰੀ ਤਰ੍ਹਾਂ ਨਾਲ ਤਿਆਰ ਹੋ ਕੇ ਖੇਡ ਖੇਡਣੀ ਪੈਂਦੀ ਐ ਤੇ ਸਾਨੂੰ ਉਸ ਲਈ ਆਰਾਮਦਾਇਕ ਕੱਪੜੇ ਜੋ ਕੀ ਨਾਇਲੋਨ ਦੇ ਹੋਣ ਤੇ ਜਾਂ ਤੇ ਉਹ ਜਾ ਅਸੀਂ ਖਿੱਚੀਏ ਤਾਂ ਉਹ ਪਾਟਣ ਵੀ ਨਾ ਤੇ ਉਹ ਸਾਡੇ ਲਈ ਆਰਾਮਦਾਇਕ ਵੀ ਹੁੰਦੇ ਹਨ